ਇੱਕੀ ਅਕਤੂਬਰ ਉੱਨੀ ਸੌ ਚੁਰਾਨਵੇਂ ਬਾਰਾਂ ਨਵੰਬਰ ਉੱਨੀ ਸੌ ਸਤਾਨਵੇਂ ਸੱਤ ਮਾਰਚ ਦੋ ਹਜ਼ਾਰ ਤੇਈ ਬਾਈ ਅਗਸਤ ਉੱਨੀ ਸੌ ਇਕਾਨਵੇਂ ਸਤਾਰਾਂ ਸਤੰਬਰ ਦੋ ਹਜ਼ਾਰ ਪੰਦਰਾਂ